ਤਕਨੋਲਜੀ ਦਾ ਸਾਡੇ ਜੀਵਨ ਉੱਪਰ ਬਹੁਤ ਵਧੀਆ ਅਸਰ ਪੈ ਰਿਹਾ ਹੈ ਅਸੀਂ ਗੱਲ ਕਰ ਰਹੇ ਹਾਂ ਮੋਬਾਈਲ ਫੋਨ ਦੀ ਮੋਬਾਇਲ ਫੋਨ ਨਾਲ ਸਾਨੂੰ ਬਹੁਤ ਫ਼ਾਇਦੇ ਮਿਲੇ ਹਨ ਜਿਵੇਂ ਕਿ ਸਾਡਾ ਕੋਈ ਦੂਰ ਬੈਠਾ ਹੁੰਦਾ ਹੈ ਅਸੀਂ ਉਸ ਨਾਲ ਗੱਲ ਕਰਨੀ ਹੁੰਦੀ ਹੈ ਤਾਂ ਸਾਨੂੰ ਬਹੁਤ ਸੌਖਾ ਹੋ ਗਿਆ ਅਸੀਂ ਇੱਕ ਮਿੰਟ ਦੇ ਵਿੱਚ ਉਸ ਨਾਲ ਚੰਗੇ ਤਰੀਕੇ ਨਾਲ ਗੱਲ ਕਰ ਸਕਦੇ ਹਾਂ ਜਿਵੇਂ ਦੂਰ ਬੈਠੇ ਇਨਸਾਨ ਨੂੰ ਅਸੀਂ ਦੇਸ਼ਾਂ ਵਿਦੇਸ਼ਾਂ ਵਿੱਚ ਦੇਖਣਾ ਹੋਵੇ ਤਾਂ ਵੀਡੀਓ ਕਾਲ ਹੋ ਜਾਂਦੀ ਹੈ ਹੋਰ ਤਾਂ ਹੋਰ ਫੋਨ ਉੱਪਰ ਅਸੀਂ ਆਪਣਾ ਬਿੱਲ ਭਰਨਾ ਹੋਵੇ ਜਾਂ ਫਿਰ ਕਹਿ ਲਓ ਕਿ ਕੁਛ ਖਾਣਾ ਵਗੈਰਾ ਮੰਗਵਾਉਣਾ ਹੋਵੇ ਘਰ ਬੈਠਿਆਂ ਨੇ ਕੁਛ ਵੀ ਕਰਨਾ ਹੋਵੇ ਬਿੱਲ ਭਰਨਾ ਨਾ ਕੋਈ ਟੀ ਵੀ ਵਗੈਰਾ ਦੇਖਣਾ ਕੋਈ ਨਿਊਜ਼ ਵਗੈਰਾ ਦੇਖਣੀ ਆ ਤਾਂ ਇਸਦਾ ਸਾਡੇ ਜ਼ਿੰਦਗੀ 'ਤੇ ਬਹੁਤ ਵਧੀਆ ਅਸਰ ਪਿਆ ਹੈ ਜੇਕਰ ਗੱਲ ਕਰੀਏ ਵਾਤਾਵਰਨ ਦੀ ਤਾਂ ਵਾਤਾਵਰਨ ਦਾ ਤਕਨੋਲਜੀ ਨਾਲ ਕੋਈ ਵੀ ਇੱਦਾਂ ਦਾ ਉਹ ਨਹੀਂ ਹੋਇਆ ਵਾਤਾਵਰਨ 'ਚ ਰੁੱਖ ਲਗਾਉਣੇ ਬਹੁਤ ਜ਼ਰੂਰੀ ਹਨ ਰੁੱਖ ਨਾ ਲਗਾਉਣ ਕਰਕੇ ਸਾਡੇ ਦੇਸ਼ ਵਿੱਚ ਦੀ ਵਾਤਾਵਰਨ ਪ੍ਰਦੂਸ਼ਣ ਬਹੁਤ ਫੈਲ ਰਿਹਾ ਹੈ ਇਸ ਲਈ ਸਾਨੂੰ ਰੁੱਖ ਲਗਾਉਣੇ ਚਾਹੀਦੇ ਹਨ ਰੁੱਖਾਂ ਤੋਂ ਬਗੈਰ ਮਨੁੱਖ ਸਾਡੇ ਦੀ ਬਹੁਤ ਜ਼ਰੂਰੀ ਫੋਨ ਤਾਂ ਇਨਸਾਨ ਲੀਏ ਇੰਨਾ ਜ਼ਰੂਰੀ ਹੋ ਗਿਆ ਹੈ ਕਿ ਫੋਨ ਤੋਂ ਬਗੈਰ ਬੰਦਾ ਕੁਛ ਵੀ ਨਹੀਂ ਕਰ ਸਕਦਾ ਫੋਨ ਤੋਂ ਬਗੈਰ ਆਪਾਂ ਫੋਨ 'ਤੇ ਰੀਚਾਰਜ ਕਰ ਸਕਦੇ ਹਾਂ ਬਿੱਲ ਭਰ ਸਕਦੇ ਹਾਂ ਕਿਸੇ ਵੀ ਡਾਕਟਰ ਦਾ ਪਤਾ ਲਗਾ ਸਕਦੇ ਹਾਂ ਕਿਸੇ ਵੀ ਐਡਰੈਸ 'ਤੇ ਜਾਣਾ ਹੋਵੇ ਉਸ ਐਡਰੈਸ ਦਾ ਪਤਾ ਕਰ ਸਕਦੇ ਹਾਂ ਟੈਕਨੋਲਜੀ ਨੇ ਸਾਡੀ ਜੀਵਨ